ਸਤਿ ਸ਼੍ਰੀ ਅਕਾਲ ਵੀਰੇ ਤਜਿੰਦਰ ਪਲੰਬਰ ਬੋਲਦੇ ਹੋ ਹਾਂ ਵੀਰੇ ਆਪਾਂ ਬਡੂੰਗਰ ਤੋਂ ਬੋਲਦੇ ਹਾਂ ਅਤੇ ਖਾਲਸਾ ਕੋਲਜ ਦੇ ਬੈਕ ਬੈਕ ਸਾਈਡ ਲੱਗਦਾ ਆਪਣਾ ਏਰੀਆ ਅਤੇ ਆਪਾਂ ਨਾ ਪਲੰਬਰਿੰਗ ਹੈ ਜੀ ਹਾਂਜੀ ਹਾਂ ਪਟਿਆਲੇ ਤੋਂ ਜੀ ਹਾਂ ਅਤੇ ਹਾਂ ਬਡੂੰਗਰ ਵਾਲੀ ਸਾਇਡ ਅਤੇ ਆਪਾਂ ਨਾ ਘਰ ਕੰਮ ਕਰਾਉਣਾ ਇਹਦਾ ਪਲੰਬਰਿੰਗ ਦਾ ਅਤੇ ਮਤਲਬ ਹਾਂ ਜੀ ਨਵਾਂ ਹੀ ਆਪਾਂ ਹੁਣੀ ਘ ਘਰ ਬਣਾ ਰਹੇ ਹਾਂ ਅਤੇ ਥੋੜ੍ਹਾ ਕੰਮ ਆ ਫਰੰਟ 'ਤੇ ਦੁਬਾਰਾ ਪਾਇਆ ਆਪਾਂ ਸਰ ਅਤੇ ਉਹ 'ਚ ਮਤਲਬ ਕਿਚਨ ਦਾ ਵੀ ਕੰਮ ਆ ਜੀ ਅਤੇ ਬਾਥਰੂਮ ਬੂਥਰੂਮ ਸਾਰੀ ਫਿਟਿੰਗ ਫੁਟਿੰਗ ਵੀ ਕਰਨੀ ਹੈ ਨਾ ਟੈਂਕੀਆਂ ਵੀ ਚਾੜਨੀਆਂ ਨੇ ਆਪਾਂ ਅਤੇ ਮੋਟਰ ਵੀ ਲਾਉਣੀ ਆ ਅਤੇ ਸਾਰਾ ਮਤਲਬ ਦੇਖ ਐਸਟੀਮੇਟ ਦੱਸ ਦਿਉ ਥੋੜ੍ਹਾ ਜਿਹਾ ਕਿੰਨਾ ਕੁ ਆ ਨਾ ਪਾਈਪਾਂ ਪੂਇਪਾਂ ਵੀ ਤੁਹਾਡੇ ਤੋਂ ਹੀ ਪਵਾਵਾਂਗੇ ਆਪਾਂ ਵੀ ਵਧੀਆ ਕੰਪਨੀਆਂ ਦੀਆਂ ਮਿਲ ਜਾਣ ਨਾਲੇ ਸਸਤੀਆਂ ਮਿਲ ਜਾਣ ਆਪਾਂ ਨੂੰ

ਨਹੀਂ ਜੀ ਪਲਾਸਟਿਕ ਵਾਲੀ ਪਾਵਾਂਗੇ ਆਪਾਂ ਵੀਰੇ ਪਰ ਵਧੀਆ ਕੰਪਨੀ ਦੀ ਵਧੀਆ ਹੋਣ ਤੁਸੀਂ ਤਾਂ ਨਾ ਤੁਹਾਡਾ ਤਾਂ ਕੰਮ ਆ ਨਿੱਤ ਦਾ ਇਹ ਤੁਹਾਨੂੰ ਤਾਂ ਪਤਾ ਹੀ ਹੋਊਗਾ ਕੋਈ ਕਿਹੜੀ ਚੀਜ਼ ਵਧੀਆ ਕਿਵੇਂ ਆ

ਨਹੀਂ ਤੁਸੀਂ ਦੇ ਦੇਣਾ ਆਪਾਂ ਨੂੰ ਮਤਲਬ ਕਿਸ ਹਿਸਾਬ ਨਾਲ ਸੈੱਟ ਬਹਿੰਦਾ ਮੇਰੇ ਵੀ ਜਿੰਮੇਵਾਰੀ ਤੁਹਾਡੀ ਹੋਜੂਗੀ ਨਾ ਤੁਸੀਂ ਆਪ ਹੀ ਕਰਦੇ ਰਿਹੋ ਫਿਰ ਅੱਛਾ ਜੀ ਹਾਂਜੀ ਅੱਛਾ ਵੀਰੇ ਹਾਂਜੀ ਅਤੇ

ਅਤੇ ਵੀਰੇ ਤੁਸੀਂ ਵਿਹਲੇ ਕਦੋਂ ਹੋਉਂਗੇ ਫਿਰ ਕਿਉਂਕਿ ਮੈਨੂੰ ਟੈਮ ਸ਼ਨੀ ਐਤਵਾਰ ਹੀ ਲੱਗਦਾ ਥੋੜ੍ਹਾ ਮੈਂ ਉਸ ਦਿਨ ਹੀ ਛੁੱਟੀ ਹੁੰਦੀ ਮੈਨੂੰ ਅਤੇ ਜੇਕਰ ਤੁਸੀਂ ਉਸ ਦਿਨ ਟੈਮ ਕੱ ਸ਼ਨੀ ਐਤਵਾਰ ਟੈਮ ਕੱਢ ਲੈਣਾ ਅੱਛਾ ਹਾਂ ਫਿਰ ਐਤਵਾਰ ਨੂੰ ਹੈ ਨਾ ਫੋਨ ਕਰ ਲਿਓ ਮੈਨੂੰ ਇੱਕ ਵਾਰ ਤੁਰਨ ਤੋਂ ਪਹਿਲਾਂ ਕਈ ਵਾਰੀ ਮੈਂ ਇੱਧਰ ਉੱਧਰ ਹੁੰਦਾ ਹਾਂ ਹਾਂ ਅਤੇ ਵੀਰ ਆਪਾਂ ਸਾਰੇ ਹੀ ਕਰਾਉਣਾ ਉਹ ਕੰਮ ਮਤਲਬ ਪਾਇਪਾਂ ਪੁਇਪਾਂ ਏ ਟੂ ਜੈੱਡ ਸਾਰਾ ਹੀ ਆ ਉਹ ਤੁਹਾਡੇ ਥਰੂ ਕਰਾਉਣਾ ਆਪਾਂ ਸਾਰਾ ਲਿਆਉਣਾ ਸਮਾਨ ਟੀਆਂ ਟੂਆਂ ਸਾਰਾ ਤੁਹਾਡੇ ਥਰੂ ਹੀ ਹੋਊਗਾ ਹਾਂ ਤੁਸੀਂ ਇੱਕ ਵਾਰੀ ਦੇਖ ਲਿਓ ਨਾ ਫਿਰ ਦੇਖ ਕੇ ਤੁਸੀਂ ਆਪਣਾ ਐਸਟੀਮੇਟ ਲਾ ਕੇ ਜਿੰਨਾ ਹੋਊਗਾ ਦੱਸ ਦਿਓ ਓਕੇ ਜੀ ਓਕੇ